ਬਜ਼ੁਰਗਾਂ ਲਈ ਬਹੁਤ ਸਾਰੀਆਂ ਸੁਵਿਧਾਵਾਂ ਹਨ ਜਿਵੇਂ ਕਿ ਬੁਢਾਪਾ ਪੈਨਸ਼ਨ ਚੱਲ ਰਹੀ ਹੈ ਅਤੇ ਬਿਰਧ ਆਸ਼ਰਮ ਬਣਾਏ ਗਏ ਹਨ ਜਿਹਨਾਂ 'ਚੋਂ ਪ੍ਰਭ ਆਸਰਾ ਅਤੇ ਰਵਾ ਰਤਵਾੜਾ ਸਾਹਿਬ ਬਿਰਧ ਆਸ਼ਰਮ ਬਹੁਤ ਮਸ਼ਹੂਰ ਹਨ